ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁੱਖ ਸਿਹਤ ਸੰਭਾਲ ਸਹੂਲਤਾਂ ਅਤੇ ਸੇਵਾਵਾਂ ਵਿੱਚ ਪੰਜਾਬ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਜਿਵੇਂ ਕਿ ਜਦੋਂ ਕੋਵਿਡ ਨਾਈਨਟੀਨ ਹੋਇਆ ਸੀ ਤਾਂ ਲੋਕ ਬਹੁਤ ਬਿਮਾਰ ਹੋ ਗਏ ਸਨ ਕੋਵਿਡ ਦੇ ਕਰਕੇ ਤਾਂ ਪੰਜਾਬ ਸਰਕਾਰ ਨੇ ਜਿਹਦੇ ਹ ਹਸਪਤਾਲ ਵਿੱਚ ਮੁਫ਼ਤ ਦਵਾਈਆਂ ਵੰਡੀਆਂ ਅਤੇ ਉਹਨਾਂ ਨੂੰ ਡੌਕਟਰਾਂ ਨੂੰ ਘਰ ਘਰ ਜਾ ਕੇ ਪੇਸ਼ੈਂਟਸਜ਼ ਦਾ ਇਲਾਜ ਕਰਨ ਲਈ ਕਿਹਾ ਅਤੇ ਉਹਨਾਂ ਨੂੰ ਫਰੀ ਸਭ ਕੁਛ ਕੀਤਾ ਅਤੇ ਫਿਰ ਉਹਨਾਂ ਨੇ ਉਹਨਾਂ ਨੂੰ ਸਟੀਮਰ ਦਿੱਤਾ ਖਾਣਾ ਪੀਣਾ ਦਿੱਤਾ ਸਭ ਕੁਛ ਦਿੱਤਾ ਉਹਨਾਂ ਨੂੰ ਰਹਿਣ ਸਹਿਣ ਦਾ ਦਿੱਤਾ ਉਹਨਾਂ ਨੂੰ ਵੱਖਰੇ ਕਮਰੇ ਦਿੱਤੇ ਫਿਰ ਉਹਨਾਂ ਨੇ ਉਹਨਾਂ ਦਾ ਪੂਰਾ ਚੈੱਕਅੱਪ ਕੀਤਾ ਜਦੋਂ ਫਿਰ ਜਦੋਂ ਤੱਕ ਉਹ ਠੀਕ ਨਹੀਂ ਹੋਏ ਉਹਨਾਂ ਨੂੰ ਘਰ ਜਾਣ ਨਹੀਂ ਦਿੱਤਾ ਅਤੇ ਉਹ ਪੰਜਾਬ ਸਰਕਾਰ ਨੇ ਹਜੇ ਤੱਕ ਫਾਰਮੇਸੀ ਹਸਪਤਾਲ 'ਚ ਵਿੱਚ ਜਿਵੇਂ ਕਿ ਗੁਰੂ ਰਾਮਦਾਸ ਹੋਸਪਿਟਲ ਹੋ ਗਿਆ ਜਿਵੇਂ ਗੁਰੂ ਨਾਨਕ ਹੋਸਪਿਟਲ ਹੋ ਗਿਆ ਉਹਨਾਂ ਨੇ ਫਰੀ ਦਵਾਈਆਂ ਵੰਡੀਆਂ ਪੰਜਾਬ ਸਰਕਾਰ ਵੱਲੋਂ ਅਤੇ ਫਿਰ ਉਹਨਾਂ ਨੇ ਉਹਨਾਂ ਦਾ ਚੈੱਕਅੱਪ ਕੀਤਾ ਜਿਹੜੇ ਬਿਮਾਰ ਸਨ ਗਰੀਬ ਜਿਹੜੇ ਗਰੀਬ ਸਨ ਪਰ ਉਨ ਉਹਨਾਂ ਨੇ ਵੀ ਪੰਜਾਬ ਸਰਕਾਰ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਜਦੋਂ ਕੋਵਿਡ ਨਾਈਨਟੀਨ ਸੀ ਉਨ ਜਦੋਂ ਜਿਨ੍ਹਾਂ ਨੂੰ ਕੋਵਿਡ ਹੋਇਆ ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਫਰੀ ਇਲਾਜ ਕੀਤਾ ਉਹਨਾਂ ਨੂੰ ਪੂਰਾ ਮਾਸਕ ਦਿੱਤਾ ਰੋਟੀ ਪਾਣੀ ਦਿੱਤੀ ਉਹਨਾਂ ਨੂੰ ਰਹਿਣ ਸਹਿਣ ਦਾ ਦਿੱਤਾ ਉਹਨਾਂ ਨੂੰ ਕੀ ਕਹਿੰਦੇ ਆ ਵੱਖਰੇ ਕਮਰੇ ਦਿੱਤੇ ਤਾਂ ਜੋ ਰਹਿ ਸਕਣ ਅਤੇ ਆਪਣਾ ਵੱਖਰੇ ਹੋ ਕੇ ਕੰਮ ਕਰ ਸਕਣ ਅਤੇ ਫਿਰ ਉਹ ਉਹਨਾਂ ਨੂੰ ਵਧੀਆ ਤਰੀਕੇ ਨਾਲ ਰਹਿਣ ਸਹਿਣ ਤਾਂ ਜੋ ਉਹਦੀ ਤਾਂ ਉਹਨਾਂ ਨੂੰ ਹਮੇਸ਼ਾ ਵੱਖਰੇ ਵੱਖਰੇ ਕਮਰਿਆਂ ਵਿੱਚ ਰੱਖਦੇ ਸਨ ਅਤੇ ਉਹ ਉਹਨਾਂ ਦੀ ਬਹੁਤ ਮਦਦ ਕੀਤੀ ਗਰੀਬ ਗਰੀਬਾਂ ਦੀ ਬਹੁਤ ਮਦਦ ਕੀਤੀ ਪੰਜਾਬ ਸਰਕਾਰ ਨੇ ਹਜੇ ਤੱਕ ਪੰਜਾਬ ਸਰਕਾਰ ਸਾਡੀ ਬਹੁਤ ਮਦਦ ਕਰ ਲਈ ਹੈ ਜਿਵੇਂ ਕਿ ਹਸਪਤਾਲ ਵਿੱਚ ਮੁੱਖਤ ਮੁਫ਼ਤ ਦਵਾਈਆਂ ਬਹੁਤ ਸਾਰੀਆਂ ਵੰਡਦੀ ਹੈ ਗਰੀਬ ਲੋਕਾਂ ਨੂੰ ਬਹੁਤ ਦਵਾਈਆਂ ਵੰਡਦੀ ਹੈ ਅਤੇ ਹੋਰ ਵੀ ਬਹੁਤ ਮਦਦ ਕੀਤੀ